ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਅਸੀਂ ਭਾਅ ਜੀ ਭੰਗੜਾ ਕਰਦੇ ਹਾਂ ਅਤੇ ਸਾਨੂੰ ਨਾ ਕੁੜਤਾ ਅਤੇ ਜੀਨਸ ਚਾਹੀਦੀਆਂ ਨੇ ਅੱਠ ਅਸੀਂ ਅੱਠ ਬੰਦੇ ਹਾਂ ਅੱਛਾ ਅਤੇ ਡਰੈੱਸ ਸਾਨੂੰ ਨਾ ਫਿਰ ਤਿੰਨ ਦਿਨ ਦੇ ਵਿੱਚ ਚਾਹੀਦੀਆਂ ਨੇ ਆ ਜੂਗੀ ਭਾਅ ਜੀ ਫਿਰ ਡਿਲੀਵਰੀ ਤੁਹਾਡੀ ਦੇਖਿਓ ਨਾ ਕੱਪੜੇ ਫਟੇ ਫਟੇ ਵੇ ਨਾ ਆਉਣ ਫੇ ਫਿਰ ਤੁਹਾਡਾ ਰੇਟ ਕਿਆ ਰੇਟ ਦੱਸ ਦਿਓ ਇੱਕ ਵਾਰ ਅਤੇ ਅੱਠ ਹਜ਼ਾਰ ਵਿੱਚ ਤੁਸੀਂ ਇੱਕ ਕੰਮ ਕਰਕੇ ਸਾਢੇ ਪੰਜ ਛੇ ਸੌ ਦਾ ਡਿਸਕਾਊਂਟ ਦੇ ਸਕਦੇ ਚਲੋ ਠੀਕ ਆ ਭਾਅ ਜੀ ਫਿਰ ਡਨ ਕਰੋ ਡਨ ਕਰੋ ਓਕੇ ਭਾਅ ਜੀ ਬਾਏ ਬਾਏ ਬਾਏ